ਮੈਂ ਗਰੀਬਾਂ ਦੇ ਹੱਕ ਦੇ ਲਈ ਹਰ ਬਚਣ ਵੱਧ ਆਪਣਾ ਤਿਆਰ ਹੁੰਦਾ ਹਾਂ ਜਦੋਂ ਕਿਤੇ ਸਮਾਜ ਅਸਵੰਦਰ ਕਿਸੇ ਵੀ ਆਪਣਾ ਤਰਾਂ ਦੀ ਕੋਈ ਮੁਸ਼ਕਿਲ ਘੜੀ ਆਉਂਦੀ ਹੈ ਸਮਾਂ ਐਸਾ ਵੀ ਆਉਂਦਾ ਕਿ ਆਪਾਂ ਹਰ ਸਮੇਂ ਉਸ ਗਰੀਬਾਂ ਦੀ ਹੱਕ ਆਪਣਾ ਗਰੀਬਾਂ ਦੇ ਹੱਕ ਦੇ ਲਈ ਆਪਣਾ ਤ ਤਿਆਰ ਹੁੰਦੇ ਹਾਂ ਪਿਛਲੇ ਸਮੇਂ ਦੌਰਾਨ ਜਿਵੇਂ ਕਰੋਨਾ ਮਾ ਮਹਾਂਮਾਰੀ ਆਈ ਸੀ ਆਪਣਾ ਜਿ ਆਪਣਾ ਅਤੇ ਉਸ ਤੋਂ ਬਾਅਦ ਹੜ੍ਹ ਵੀ ਆਏ ਸਨ ਅਤੇ ਕਰੋਨਾ ਮਹਾਂਮਾਰੀ ਮਾਰੀ ਨੇ ਅਤੇ ਹੜ੍ਹਾਂ ਨੇ ਜੋ ਗਰੀਬਾਂ ਦੇ ਅਤੇ ਆਪਣਾ ਕੀਤਾ ਸੀ ਪ੍ਰਭਾਵ ਅੱਛਾ ਵੀ ਉਹਨਾਂ ਉੱਤੇ ਤਾਂ ਉ ਅੱਛਾ ਉਹ ਸਮੇਂ ਦੇ ਦੌਰਾਨ ਮੈਨੂੰ ਨਹੀਂ ਸੀ ਅੱਛਾ ਵਈ ਪਤਾ ਕਿ ਮੇਰਾ ਯੋਗਦਾਨ ਦੀ ਫੋਟੋ ਆਪਣਾ ਕੰਮ ਆਪਣਾ ਕਰਦੇ ਕਿ ਅਖਬਾਰ ਵਿੱਚ ਵੀ ਆਏਗੀ ਮੈਂ ਤਾਂ ਇੱਕ ਸਮਾਜ ਦੇ ਤੌਰ 'ਤੇ ਅਛ ਤੇ ਅੱਛਾ ਇਨਸਾਨੀਅਤ ਦੇ ਤੌਰ 'ਤੇ ਉਹਨਾਂ ਦੀ ਹੈਲਪ ਆਪਣਾ ਕਰੀ ਉਹਨਾਂ ਦੀ ਮਦਦ ਆਪਣਾ ਕਰੀ ਵ ਜਿਹੜਾ ਨੂੰ ਆਪਣਾ ਖਾਣੇ ਦੀ ਆਪਣਾ ਲੋੜ ਸੀ ਲੋਕਾਂ ਨੂੰ ਉਸ ਟਾਈਮ 'ਤੇ ਉਹਨਾਂ ਨੂੰ ਖਾਣੇ ਦਾ ਇੰਤਜ਼ਾਮ ਆਪਣਾ ਕੀਤਾ ਜਿੰਨਾ ਕੋਲ ਕੱਪੜੇ ਨਹੀਂ ਸਨ ਉਹਨਾਂ ਨੂੰ ਕੱਪੜੇ ਖਰੀਦ ਕੇ ਆਪਣਾ ਦਿੱਤੇ ਅਤੇ ਉਸ ਦੇ ਨਾਲ ਨਾਲ ਜਿਹੜੇ ਲੋਕ ਆਰਥਿਕ ਤੰਗੀ ਝੱਲਦੇ ਸਨ ਅੱਛਾ ਵੀ ਉਹਨਾਂ ਨੂੰ ਕੋਈ ਮਾਲੀ ਸਹਾਇਤਾ ਵਈ ਆਪਣਾ ਦਿੱਤੀ ਤਾਂ ਇਹ ਮੇਰਾ ਇੱਕ ਸੁਪਨਾ ਸੀ ਕਿ ਮੈਂ ਜੇ ਕਿਸੇ ਦਾ ਭਲਾ ਆਪਣਾ ਕਰਾਂਗਾ ਕੀ ਉਸ ਪਰਮਾਤਮਾ ਅੱਗੇ ਜਾਂ ਅਕਾਲ ਪੁਰਖ ਅਛਾ ਵੀ ਅੱਗੇ ਕੀ ਮੈਂ ਇਹ ਕਹਿ ਸਕਾਂਗਾ ਕਿ ਮਾਲਕਾ ਵੀ ਅੱਜ ਮੈਂ ਕਿਸੇ ਬੰਦੇ ਦਾ ਭਲਾ ਆਪਣਾ ਕੀਤਾ ਕਿ ਮਾਲਕ ਆਪਣਾ ਸਾਡਾ ਵੀ ਅਛਾ ਵੀ ਭਲਾ ਕਰੇ ਪਰ ਇਸ ਦੌਰਾਨ ਜੋ ਸੋਸ਼ਲ ਮੀਡੀਆ 'ਤੇ ਮੇਰੀ ਫੋਟੋ ਸੀ ਉਹ ਜਾਣੀ ਕਿ ਉਹਨਾਂ ਨੇ ਅਖਬਾਰ ਵਿੱਚ ਆਪਣਾ ਲਾ ਦਿੱਤੀ ਉਹ ਚੀਜ਼ ਦੀ ਵੀ ਮੈਨੂੰ ਬੜੀ ਆਪਣਾ ਖੁਸ਼ੀ ਹੈ ਵੀ ਮਾਣ ਹੈ ਵੀ ਇੱਕ ਮੇਰਾ ਵੀ ਨਾਂ ਹੈ ਰੁਤਬਾ ਹੈ ਜਾਣੀ ਕਿ ਸੰਸਾਰ ਅਛਾ ਵੀ ਅੰਦਰ ਜਦ ਮੈਂ ਉਹ ਆਪਣੀ ਪੁਰਾਣੀ ਫੋਟੋ ਆਪਣਾ ਦੇ ਵੀ ਦੇਖਦਾ ਕਿ ਮੇਰੀਆਂ ਅੱਖਾਂ ਦੇ ਵਿੱਚ ਹੰਜੂ ਆਉਂਦੇ ਨੇ ਵੀ ਮੈਂ ਇਹ ਗੱਲ ਮਹਿਸੂਸ ਆਪਣਾ ਕਰਨਾ ਕਿ ਜੇ ਮੈਂ ਕਿਸੇ ਦੀ ਮਦਦ ਕੀਤੀ ਹੈ ਵੀ ਅੱਜ ਤਾਂ ਹੀ ਮੇਰੀ ਅਖਬਾਰ ਅੰਦਰ ਕੋਈ ਫੋਟੋ ਹੈ ਤਾਂ ਇਹ ਚੀਜ਼ ਬਹੁਤ ਅੱਛਾ ਵਧੀਆ ਮੈਂ ਤਾਂ ਇਹ ਕਹਿੰਦਾ ਕਿ ਹਰੇਕ ਅੱਛਾ ਇਨਸਾਨ ਨੂੰ ਕਿਸੇ ਦੀ ਹੈਲਪ ਆਪਣਾ ਕਰੋ ਕਿਸੇ ਦੀ ਮਦਦ ਕਰੋ ਕਿਉਂਕਿ ਜੇ ਆਪਾਂ ਕਿਸੇ ਦੀ ਮਦਦ ਕਰਾਂਗੇ ਕਿ ਉਹਦੀਆਂ ਅਸੀਸਾਂ ਦੇ ਨਾਲ ਹੀ ਸਭ ਕੁਛ ਹੈ